ਪੰਜਾਬ ਦੇ ਸੱਭਿਆਚਾਰ ਵਿੱਚ ਸਭ ਤੋਂ ਅੱਛਾ ਤਾਂ ਇੱਕ ਆਰਕੀਟੈਕਚਰ ਹੈ ਜੋ ਕਿ ਹਰ ਬਿਲਡਿੰਗ ਦਾ ਇੱਕੋ ਤਰ੍ਹਾਂ ਦਾ ਹੈ ਅਤੇ ਉਹ ਤੋਂ ਬਾਅਦ ਲੋਕਾਂ 'ਚ ਵੀਰਤਾ ਹੈ ਤਾਂ ਹੀ ਇਸ ਕਰਕੇ ਹੀ ਜਿਹੜੇ ਪੰਜਾਬੀ ਲੋਕ ਨੇ ਉਹ ਜ਼ਿਆਦਾ ਫੌਜ ਵਿੱਚ ਭਰਤੀ ਹੁੰਦੇ ਹਨ ਸ਼ੁਰੂ ਤੋਂ ਹੀ ਆਪਾਂ ਨੇ ਦੇਖਿਆ ਹੈ ਕਿ ਆਜ਼ਾਦੀ ਦੇ ਦੌਰਾਨ ਅਤੇ ਬਾਕੀ ਜਿਹੜਾ ਯੁੱਧ ਦੇ ਦੌਰਾਨ ਪੰਜਾਬੀਆਂ ਦਾ ਕੋਂਟਰੀਬਿਊਸ਼ਨ ਜ਼ਿਆਦਾ ਰਹਿੰਦਾ ਹੈ